ਮੈਂ ਘਰ ਵਿੱਚ ਬਨਾਨਾ ਸ਼ੇਕ ਮੈਨਗੋ ਸ਼ੇਕ ਜਲਜੀਰਾ ਸ਼ੱਕਰ ਅਤੇ ਸੱਤੂ ਦਾ ਰਸ ਆਦਿ ਬਣਾਉਂਦੀ ਹਾਂ ਇਹ ਚੀਜ਼ਾਂ ਬਣਾਉਣ ਲਈ ਮੈਂ ਸਰਬਤ ਪਹਿਲਾਂ ਹੀ ਤਿਆਰ ਕਰਕੇ ਰੱਖਦੀ ਹਾਂ ਸਾਡੇ ਘਰ ਵਿੱਚ ਕੋਲਡ ਕੋਫੀ ਅਦਿ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਚੱਲਦੀ ਹੈ ਇਹਨਾਂ ਚੀਜ਼ਾਂ ਨੂੰ ਤਿਆਰ ਤਿਆਰ ਕਰਨ ਲਈ ਜੋ ਵੀ ਮਟੀਰੀਅਲ ਮੈਨੂੰ ਚਾਹੀਦਾ ਹੈ ਪਹਿਲਾਂ ਤਿਆਰ ਕਰਕੇ ਰੱਖਦੀ ਹਾਂ ਤਾਂ ਕਿ ਆਉਣ ਵਾਲੇ ਮਹਿਮਾਨ ਲਈ ਮੈਂ ਫਟਾਫਟ ਤਿਆਰ ਕਰ ਸਕਾਂ ਇਸ ਕਰਕੇ ਇਹਨਾਂ ਚੀਜ਼ਾਂ ਦੀ ਪਹਿਲਾਂ ਹੀ ਤਿਆਰੀ ਕ ਕਰ ਲਈ ਜਾਂਦੀ ਹੈ